ਤੈਰਾਕਾਂ ਦੇ ਕੰਨ ਅਤੇ ਹੋਰ ਆਮ ਤੈਰਾਕੀ ਨਾਲ ਸੰਬੰਧਿਤ ਸੱਟਾਂ ਨੂੰ ਰੋਕਣ ਦੇ ਕਈ ਤਰੀਕੇ ਹਨ ਜਿੱਦਾਂ ਜਦੋਂ ਅਸੀਂ ਤੈਰਾਕੀ ਮਾਰਦੇ ਹਨ ਤਾਂ ਸਾਨੂੰ ਨੱਕ ਬੰਦ ਅਤੇ ਕੰਨ ਬੰਦ ਕਰਕੇ ਤੈਰਾਕੀ ਮਾਰਨੀ ਚਾਹੀਦੀ ਹੈ ਕਿਉਂਕਿ ਜੇਕਰ ਅਸੀਂ ਤੈਰਾਕੀ ਨੱਕ ਬੰਦ ਜਾਂ ਫਿਰ ਕੰਨ ਬੰਦ ਕਰਕੇ ਨਹੀਂ ਮਾਰਦੇ ਤਾਂ ਉਹ ਨੱਕ ਜਾਂ ਫਿਰ ਪਾਣੀ ਚਲ ਜਾਂਦਾ ਹੈ ਅਤੇ ਕੰਨ ਵਿੱਚ ਵੀ ਪਾਣੀ ਚਲ ਜਾਂਦਾ ਹੈ ਅਤੇ ਹੋਰ ਵੀ ਕਈ ਤਰੀਕੇ ਹੁੰਦੇ ਹਨ ਇਸ ਤੋਂ ਬਚਣ ਲਈ ਜਿੱਦਾਂ ਅਸੀਂ ਜੇ ਉੱਚੀ ਤੋਂ ਉੱਚੀ ਚੱਟਾਨ ਤੋਂ ਛਲਾਂਗ ਮਾਰਦੇ ਹਨ ਤਾਂ ਨੱਕ ਉੱਤੇ ਹੱਥ ਰੱਖ ਕੇ ਅਸੀਂ ਥੱਲੇ ਛਲਾਂਗ ਮਾਰ ਸਕਦੇ ਹਾਂ ਜਿਸ ਕਾਰਨ ਅਸੀਂ ਬਚ ਸਕਦੇ ਹਾਂ ਅਤੇ ਤੈਰਾਕੀ ਪੋਸ਼ਾਕ ਅਤੇ ਕੈਪ ਚਸ਼ਮਾ ਵੀ ਬਹੁਤ ਵਧੀਆ ਰੀਜ਼ਨ ਹੈ ਜਿਸ ਕਾਰਨ ਅਸੀਂ ਬਚਦੇ ਹਨ ਕਿਉਂਕਿ ਇਸ ਨਾਲ ਜਿਹੜੇ ਬੇਕਾਰ ਤੋਂ ਬੇਕਾਰ ਤੈਰਾਕ ਵੀ ਹੁੰਦੇ ਹਨ ਉਹ ਵੀ ਅੱਛੀ ਤੋਂ ਅੱਛੀ ਤੈਰਾਕੀ ਕਰ ਲੈਂਦੇ ਹਨ ਉਹਨਾਂ ਦੇ ਕੋਈ ਵੀ ਸੱਟ ਨਹੀਂ ਲੱਗਦੀ ਅਤੇ ਉਹਨਾਂ ਦੇ ਕੰਨ ਅਤੇ ਨੱਕ 'ਚ ਪਾਣੀ ਨਹੀਂ ਜਾਂਦਾ